ਪੁਰਾਣੀਆਂ ਪੀੜ੍ਹੀਆਂ ਵਿੱਚ ਸੰਯੁਕਤ ਪਰਿਵਾਰ ਸਨ ਵੱਡੇ ਵੱਡੇ ਪਰਿਵਾਰ ਸਨ ਬਜ਼ੁਰਗ ਦਾਦੇ ਦਾਦੀਆਂ ਬੱਚਿਆਂ ਨੂੰ ਰਾਤ ਵੇਲੇ ਸੌਣ ਲੱਗਿਆਂ ਗੁਰੂਆਂ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ ਬਾਤਾਂ ਸੁਣਾਇਆ ਕਰਦੇ ਸਨ ਲੇਕਿਨ ਅੱਜ ਕਿਉਂਕਿ ਪਰਿਵਾਰ ਸੰਯੁਕਤ ਨਹੀਂ ਹਨ ਛੋਟੇ ਪਰਿਵਾਰ ਹੋ ਗਏ ਹਨ ਮਾਤਾ ਪਿਤਾ ਦੋਨੋਂ ਹੀ ਨੌਕਰੀਆਂ ਕਰਦੇ ਹੈ ਜਾਂ ਕੋਈ ਵੀ ਕੰਮ ਕਰਦੇ ਹਨ ਉਹਨਾਂ ਕੋਲ ਇੰਨਾਂ ਵਕਤ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਹਾਣੀਆਂ ਜਾਂ ਧਰਮ ਬਾਰੇ ਕੋਈ ਸਿੱਖਿਆ ਦੇ ਸਕਣ ਸਮਾਜ ਵਿੱਚ ਤਾਂ ਧਾਰਮਿਕ ਸਿੱਖਿਆ ਬਹੁਤ ਫੈਲ ਰਹੀ ਹੈ ਬਹੁਤ ਸਾਰੇ ਧਾਰਮਿਕ ਕਮਿਸ਼ਨ ਬਣੇ ਹੋਏ ਹਨ ਜੋ ਕਿ ਧਰਮ ਬਾਰੇ ਪ੍ਰਚਾਰ ਕਰਦੇ ਹਨ ਲੇਕਿਨ ਘਰਾਂ ਦੇ ਵਿੱਚ ਸੋਚਿਆ ਜਾਵੇ ਤਾਂ ਮਾਤਾ ਪਿਤਾ ਕੋਲ ਇੰਨਾਂ ਵਕਤ ਨਹੀਂ ਹੈ ਨਾ ਹੀ ਉਹ ਕੋਸ਼ਿਸ਼ ਕਰਦੇ ਹਨ ਕਿ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਵੇ ਇਸ ਤੋਂ ਇਲਾਵਾ ਉਹ ਟੀਵੀ ਲਾ ਕੇ ਸੀਰੀਅਲ ਵੇਖ ਲੈਣਗੇ ਮਾਤਾ ਮਾਤਾ ਪਿਤਾ ਸੀਰੀਅਲ ਤਾਂ ਵੇਖ ਲੈਂਦੇ ਹਨ ਮੋਬਾਈਲ ਖੋਲ੍ਹ ਕੇ ਉੱਥੋਂ ਕਈ ਕੁਝ ਵੇਖਦੇ ਹਨ ਪਰ ਬੱਚਿਆਂ ਨੂੰ ਧਾਰਮਿਕ ਸਿੱਖਿਆ ਨਹੀਂ ਦਿੰਦੇ ਇਹ ਮਾਤਾ ਪਿਤਾ ਦੀ ਵੀ ਗਲਤੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਮੋਬਾਈਲ ਛੱਡ ਕੇ ਟੀਵੀ ਛੱਡ ਕੇ ਬੱਚਿਆਂ ਦੇ ਨਾਲ ਕੁਝ ਸਮਾਂ ਬਤੀਤ ਕਰਨ ਅਤੇ ਉਹਨਾਂ ਨੂੰ ਧਾਰਮਿਕ ਸਿੱਖਿਆ ਦਿੱਤੀ ਜਾਵੇ ਧੰਨਵਾਦ